ਵੈਸੇ ਤਾਂ ਆਪਾਂ ਗੱਲ ਕਰਾਂਗੇ ਅੱਜ ਸਾਹਿਤ ਦੇ ਬਾਰੇ ਕਿ ਸਾਹਿਤ ਭਾਸ਼ਾ ਦੀ ਵੈਸੇ ਤਾਂ ਵਰਤੋਂ ਆਪਣੇ ਪੰਜਾਬੀ ਭਾਸ਼ਾ ਦੀ ਸੰਭਾਲ ਵਾਸਤੇ ਕੀਤੀ ਜਾ ਰਹੀ ਹੈ ਜਿਵੇਂ ਕਿ ਇਸ ਵਿੱਚ ਕੋਈ ਵੀ ਪੰਜਾਬੀ ਭਾਸ਼ਾ ਦੇ ਵਿੱਚ ਕੋਈ ਵੀ ਸੱਭ ਸੱਭਿਆਚਾਰਕ ਕੋਈ ਗੀਤ ਆਉਂਦਾ ਉਹ ਸਾਰਾ ਸਾਹਿਤ ਦੇ ਨਾਲ਼ ਹੀ ਲਿੰਕਡ ਹੁੰਦਾ ਏ ਆ ਅਤੇ ਇਸ ਦੇ ਵਿੱਚ ਆਪਣੀ ਪੰਜਾਬੀ ਭਾਸ਼ਾ ਨੂੰ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਜਗ੍ਹਾ ਜਗ੍ਹਾ ਤੱਕ ਸਾਹਿਤ ਦੇ ਜ਼ਰੀਏ ਹੀ ਪਹੁੰਚਾਇਆ ਜਾ ਰਿਹਾ ਹੈ ਸਾਹਿਤ ਦੇ ਨਾਲ਼ ਹੀ ਜਦੋਂ ਪੰਜਾਬੀ ਭਾਸ਼ਾ ਦੀ ਆਪਾਂ ਅਗਰ ਗੱਲ ਕਰਦੇ ਹਾਂ ਤਾਂ ਥਾਂ ਥਾਂ ਦੇ ਵਿੱਚ ਸਾਹਿਤ ਦੇ ਕਰਕੇ ਹੀ ਪੰਜਾਬੀ ਭਾਸ਼ਾ ਆਪਣੀ ਪਹੁੰਚਦੀ ਹੈ ਸੱਭਿਆਚਾਰਕ ਆਪਣਾ ਪਹੁੰਚਦਾ ਹੈ